ਜ਼ਿੰਦਗੀ ਦੇ ਵਿੱਚ ਕਲਾ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਕਲਾ ਦੇ ਰਾਹੀਂ ਅਸੀਂ ਆਪਣਾ ਬਹੁਤ ਕੁਛ ਦੱਸ ਸਕਦੇ ਹਾਂ ਜਦੋਂ ਇੱਕ ਪੇਂਟਰ ਕਿਸੇ ਪੇਂਟਿੰਗ ਨੂੰ ਬਣਾਉਂਦਾ ਉਹ ਪੇਂਟਿੰਗ ਸਾਨੂੰ ਬਹੁਤ ਚੀਜ਼ਾਂ ਵੱਲ ਇਸ਼ਾਰੇ ਕਰਦੀ ਹੈ ਕਿਉਂਕਿ ਜਿਹੜੀ ਕਲਾ ਹੈ ਉਹ ਬੋਲਦੀ ਨਹੀਂ ਉਹ ਸਿਰਫ਼ ਦਰਸਾਉਂਦੀ ਹੈ ਅਸੀਂ ਉਹ ਪੇਂਟਿੰਗ ਨੂੰ ਦੇਖ ਕੇ ਬਹੁਤ ਸਾਰੀਆਂ ਚੀਜ਼ਾਂ ਦਾ ਅੰਦਾਜ਼ਾ ਲਗਾਉਂਦੇ ਹਾਂ ਵੀ ਇਹ ਕਿਸ ਚੀਜ਼ ਬਾਰੇ ਸਾਨੂੰ ਨੋਲੇਜ ਦੇ ਰਹੀ ਹੈ ਇਹਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ ਕਲਾ ਦੇ ਨਾਲ਼ ਅਸੀਂ ਜੇ ਸਾਡੇ 'ਚ ਇਹ ਕਲਾ ਹੈ ਤਾਂ ਸਾਡਾ ਇਸ ਟਾਈਮ ਯੂਟੀਲਾਈਜ ਹੁੰਦਾ ਹੈ ਸਾਡਾ ਸਟ੍ਰੈੱਸ ਦੂਰ ਹੁੰਦਾ ਇੱਕ ਚੰਗਾ ਪੇਂਟਰ ਬਹੁਤ ਵਧੀਆ ਪੇਂਟਿੰਗ ਬਣਾ ਕੇ ਜਦੋਂ ਉਹਨੂੰ ਸੇਲ ਕਰਦਾ ਤਾਂ ਉਹਦੇ ਤੋਂ ਉਹਨੂੰ ਅਰਨਿੰਗ ਬਹੁਤ ਹੁੰਦੀ ਹੈ ਉਹਦਾ ਨਾਮ ਬਣਦਾ ਦੇਸ਼ ਦੇ ਵਿੱਚ ਤਾਂ ਸਾਡੇ ਇੰਡੀਆ ਦੇ ਵਿੱਚ ਬਹੁਤ ਚੰਗੇ ਚੰਗੇ ਪੇਂਟਰ ਹਨ ਜਿਹੜੇ ਮਤਲਬ ਕਿ ਕਲਾ ਦੇ ਵਿੱਚ ਬਹੁਤ ਮਸ਼ਹੂਰ ਮੰਨੇ ਜਾਂਦੇ ਆ ਹਰ ਇੱਕ ਦੇ ਵਿੱਚ ਜਿਹੜੀ ਇਹ ਕਲਾ ਹੋਣੀ ਬਹੁਤ ਜ਼ਰੂਰੀ ਹੈ